ਹਾਂਜੀ ਮੈਂ ਸੋਚਦੀ ਹਾਂ ਮੇਰੀ ਸਭ ਤੋਂ ਵੱਡੀ ਜਿਹੜੀ ਪਾਵਰ ਹੈ ਉਹ ਹੈ ਮੈਂ ਸਭ 'ਤੇ ਟਰੱਸਟ ਕਰਦੀ ਹਾਂ ਜਿਸ ਐਨਵਾਇਰਮੈਂਟ ਜਿਸ ਵਾਤਾਵਰਨ ਦੇ ਵਿੱਚ ਮੈਂ ਜਾਂਦੀ ਹਾਂ ਮੈਂ ਬਹੁਤ ਛੇਤੀ ਜਿਹੜਾ ਉੱਥੇ ਆਪਣੇ ਆਪ ਨੂੰ ਐਡਜਸਟ ਕਰ ਲੈਂਦੀ ਹਾਂ ਮੈਨੂੰ ਕਿਸੇ ਨਾਲ ਵੀ ਰਹਿਣ ਖਾਣ ਪੀਣ 'ਚ ਕੋਈ ਪ੍ਰੋਬਲਮ ਨਹੀਂ ਆਉਂਦੀ ਅਤੇ ਮੈਂ ਜਿਹੜੀ ਮਤਲਬ ਕਿ ਸਭ 'ਤੇ ਬਹੁਤ ਛੇਤੀ ਜਿਹੜਾ ਵਿਸ਼ਵਾਸ ਕਰਦੀ ਹਾਂ ਸਭ ਨੂੰ ਮੈਂ ਜਿਹਦੇ ਨਾਲ ਵੀ ਰਹਿੰਦੀ ਹੈ ਮੈਂ ਸਭ ਨੂੰ ਜਿਹੜੀ ਆਪਣੇ ਮਤਲਬ ਕਿ ਆਪਣਾ ਹੀ ਸਮਝਦੀ ਹਾਂ ਵੀ ਉਹ ਮੇਰਾ ਹੀ ਹੈ ਅਤੇ ਜਿਹੜੀ ਮੇਰੀ ਕਮਜ਼ੋਰੀ ਹੈ ਮੇਰੀ ਕਮਜ਼ੋਰੀ ਇਹ ਹੈ ਕਿ ਮੈਂ ਮਤਲਬ ਕਿ ਲੇਟ ਉੱਠ ਉੱਠਣ ਕਾਰਨ ਜਿਹੜੇ ਮੇਰੇ ਕੰਮ ਆ ਉਹ ਲੇਟ ਹੋ ਜਾਂਦੇ ਆ ਬਹੁਤੇ ਕੰਮ ਜਿਹੜੇ ਮੇਰੇ ਰਹਿ ਜਾਂਦੇ ਹੈ ਜਿਹੜੀ ਮੇਰੀ ਲਾਈਫ ਦੀ ਇਹ ਸਭ ਤੋਂ ਵੱਡੀ ਕਮਜ਼ੋਰੀ ਹੈ ਇੱਕ ਮੈਨੂੰ ਬਹੁਤ ਜਿਹੜਾ ਗੁੱਸਾ ਆਉਂਦਾ ਹੈ ਜਿਹੜਾ ਗੁੱਸਾ ਆਉਣ ਕਰਕੇ ਕਿ ਮੇਰਾ ਮਤਲਬ ਕਿ ਸਾਰਾ ਦਿਨ ਖਰਾਬ ਹੁੰਦਾ ਹੈ ਉਹਦਾ ਇਫੈਕਟ ਹੈ ਜਿਹੜਾ ਉਹਦਾ ਅਸਰ ਮੇਰੀ ਹੈਲਥ 'ਤੇ ਪੈਂਦਾ ਹੈ ਹੈਲਥ 'ਤੇ ਪੈਣ ਪੈਂਦਾ ਹੈ ਅਤੇ ਜਿਹਦੀ ਮਤਲਬ ਕਿ ਹੈਲਥ 'ਚ ਕਈ ਪ੍ਰੋਬਲਮਜ਼ ਆਉਂਦੀਆਂ ਨੇ